ਹੈਲੋ ਬਾਈ ਇੱਕ ਮਿੰਟ ਗੱਲ ਸੁਣੀ ਯਾਰ ਬਾਈ ਆਪਾਂ ਨਾ ਮੈਨੂੰ ਅਏਂ ਲੱਗਦਾ ਲੇਟ ਹੋਈ ਜਾਂਦੇ ਹਾਂ ਬਹੁਤ ਜ਼ਿਆਦਾ ਟਰੈਫਿਕ ਹੋਇਆ ਪਿਆ ਆਸੇ ਪਾਸੇ ਅਤੇ ਜਾਮ ਲੱਗਿਆ ਪਿਆ ਤੁਹਾਨੂੰ ਵੀ ਪਤਾ ਹੈ ਨਾ ਅਤੇ ਮੇਰਾ ਯਾਰ ਅੱਗੇ ਕਲਾਈਂਟ ਆਇਆ ਬੈਠਾ ਹੈਗਾ ਔਫਿਸ ਦੇ ਵਿੱਚ ਅਤੇ ਆਪਾਂ ਜਾਣਾ ਵੀ ਹਾਲੇ ਤੱਕ ਚਾਰ ਪੰਜ ਕਿਲੋਮੀਟਰ ਬਹੁਤ ਦੂਰ ਹੈਗੇ ਆਪਾਂ ਅਤੇ ਜੇ ਇਸ ਹਿਸਾਬ ਨਾਲ ਚੱਲਦੇ ਰਹੇ ਆਪਣੇ ਤੋਂ ਪਹੁੰਚਿਆ ਨਹੀਂ ਜਾਣਾ ਅਤੇ ਯਾਰ ਮੇਰੀ ਮਜਬੂਰੀ ਸਮਝ ਤੂੰ ਐਵੇਂ ਕਰ ਇੱਥੋਂ ਨਾ ਜਿਹੜਾ ਅਗਲਾ ਚੌਕ ਆਊਗਾ ਉੱਥੋਂ ਗੱਡੀ ਨੂੰ ਘੁੰਮਾ ਕੇ ਹੋਰ ਰਸਤੇ ਵਿੱਚ ਦੀ ਲੈ ਜਾ ਅਤੇ ਉਹ ਉਸ ਰਸਤੇ ਨਾਲ ਆਪਾਂ ਨੂੰ ਮੈਨੂੰ ਆਏਂ ਲਗਦਾ ਜਲਦੀ ਪਹੁੰਚ ਜਾਵਾਂਗੇ ਜੇ ਆਪਾਂ ਇਸੇ ਰਫਤਾਰ 'ਤੇ ਚੱਲਦੇ ਰਹੇ ਤਾਂ ਆਪਣੇ ਤੋਂ ਪਹੁੰਚਿਆ ਨਹੀਂ ਜਾਣਾ ਬਾਈ ਅਤੇ ਮੇਰਾ ਅੱਗੇ ਯਾਰ ਟਾਈਮ ਹੋਈ ਜਾਂਦਾ ਮੇਰੀ ਮਜਬੂਰੀ ਨੂੰ ਸਮਝ ਆਪਣੇ ਤੋਂ ਪਹੁੰਚਿਆ ਨਹੀਂ ਜਾਣਾ ਅਤੇ ਗੱਡੀ ਥੋੜ੍ਹੀ ਜਿਹੀ ਤੇਜ਼ ਚਲਾ ਅਤੇ ਨਾਲੇ ਆਏਂ ਦੱਸ ਵੀ ਆਪਾਂ ਨੂੰ ਟੈਮ ਕਿੰਨਾ ਕੁ ਲੱਗਜੂਗਾ ਇੱਥੋਂ ਹੋਰ ਨਿਕਲਦੇ ਨਿਕਲਦੇ ਜੇ ਮੰਨ ਲਓ ਆਪਾਂ ਇਸ ਰਸਤੇ ਜਾਂਦੇ ਹਾਂ ਤਾਂ ਕਿੰਨਾ ਕੁ ਟੈਮ ਲੱਗੂਗਾ ਹੋਰ ਮੇਰੇ ਹਿਸਾਬ ਨਾਲ ਵੀਹ ਪੱਚੀ ਮਿੰਟਾਂ ਤੋਂ ਪਹਿਲਾਂ ਆਪਾਂ ਨਹੀਂ ਨਿਕਲਦੇ ਅਤੇ ਓਥੇ ਮੈਂ ਉਨ੍ਹਾਂ ਨੂੰ ਯਾਰ ਟੈਮ ਦੇਈ ਬੈਠਾਂਗਾ ਅਤੇ ਆਏਂ ਕਰ ਤੂੰ ਰਸਤਾ ਬਦਲ ਅਤੇ ਗੱਡੀ ਥੋੜ੍ਹੀ ਜਿਹੀ ਤੇਜ਼ ਚਲਾ ਅਤੇ ਕਰ ਯਾਰ ਮੇਰਾ ਵੀਰ ਕੁਛ ਮਾੜਾ ਜਿਹਾ ਖਿੱਚ ਇਹਨੂੰ ਗੱਡੀ ਨੂੰ ਅਤੇ ਆਪਾਂ ਪਹੁੰਚੀਏ ਅਤੇ ਜੇ ਲੇਟ ਹੋ ਗਿਆ ਤਾਂ ਯਾਰ ਔਖਾ ਹੋਜੂਗਾ ਬੰਦੇ ਬਹੁਤ ਦੂਰੋਂ ਆਏ ਹੈਗੇ ਮਾੜੀ ਜਿਹੀ ਮਜਬੂਰੀ ਸਮਝ ਵੀਰ ਬਣ ਕੇ ਖਿੱਚ ਦੇ ਮਾੜਾ ਜਿਹਾ